ਪੰਜਾਬ ਜਿਹੜਾ ਵੱਖ ਵੱਖ ਖੇਤਰਾਂ 'ਚ ਜਿਵੇਂ ਕਹਿ ਸਕਦੇ ਹੈਗੇ ਹਾਂ ਸੱਭਿਆਚਾਰਕ ਅੰਤਰ ਕੀ ਪਿਆ ਹੈਗਾ ਵਾ ਜਿਹੜੀ ਆਪਾਂ ਆਪਣਾ ਜਿਹੜਾ ਸਟਾਇਲ ਹੈ ਚੇਂਜ ਕੀਤਾ ਹੈਗਾ ਵਾ ਆਪਾਂ ਜਿਹੜਾ ਹੈਗਾ ਵਾ ਆਪਾਂ ਵੇਖ ਕੇ ਕਿ ਹਾਂ ਬਈ ਇਹ ਲੋਕ ਪਹਿਨਦੇ ਹੈਗੇ ਬਾਹਰਲੇ ਦੇਸ਼ ਦੇ ਆਪਾਂ ਕਹਿ ਸਕਦੇ ਹੈਗੇ ਹਾਂ ਜਾਂ ਆਪਾਂ ਨੂੰ ਤਾਂ ਜਿਹੜਾ ਬੈਸਟ ਆਪਾਂ ਵੇਖਦੇ ਹੈਗੇ ਜੇ ਦਿੱਲੀ ਵੈੱਬਸਾਈਟ 'ਤੇ ਆਪਾਂ ਉਹਨਾਂ ਨੂੰ ਵੇਖ ਕੇ ਆਪਾਂ ਨੂੰ ਰੈਕਮੋਟੇਸ਼ਨ ਕਰਦੇ ਹੈਗੇ ਹਾਂ ਅਤੇ ਮੀਨਜ਼ ਆਪਾਂ ਕੀ ਆ ਅਰਬਨਾਈਜ਼ਡ ਵੇਖਣਾ ਚਾਹੁੰਦੇ ਆਪਾਂ ਸ਼ਹਿਰੀਕਰਨ ਕਰਨ ਡਏ ਹੈਗੇ ਹਾਂ ਅਤੇ ਇਹ ਕੀ ਹੈ ਸਭ ਤੋਂ ਜ਼ਿਆਦਾ ਹੀ ਵੱਡਾ ਅੰਤਰ ਹੈਗਾ ਵਾ